ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਅੰਜਲੀ ਕੀ ਹਾਲ ਚਾਲ ਹੈ ਬਸ ਠੀਕ ਠਾਕ ਬਸ ਜੀ ਕੁਛ ਨਹੀਂ ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਤੁਹਾਡਾ ਵਲੋਗ ਵਲੋਗਿੰਗ ਕਿਵੇਂ ਚੱਲ ਰਹੀ ਤੁਹਾਡੀ ਹਾਂਜੀ ਹਾਂਜੀ ਪੁੱਛੋ ਜੀ ਹਾਂ ਹਾਂ ਹਾਂ ਓਕੇ ਓਕੇ ਓਕੇ ਓਕੇ ਬੇਕਰੀਜ਼ ਤਾਂ ਇੱਥੇ ਬਹੁਤ ਨੇ ਇੱਥੇ ਫੇਮਸ ਵੀ ਬੜੀਆਂ ਨੇ ਅਤੇ ਇੱਥੇ ਰਾਮਾ ਬੇਕਰੀ ਹੋ ਗਈ ਅਰਜਨ ਬੇਕਰੀ ਹੋ ਗਈ ਇੱਕ ਡਰੀਮ ਬੇਕਰਸ ਹੈਗੀ ਆ ਆਪਣੇ ਬੱਸ ਸਟੈਂਡ ਦੇ ਨੇ ਨੇੜੇ ਅਤੇ ਹੋਮ ਬੇਕਰਜ਼ ਵੀ ਹੈਗੇ ਇੱਥੇ ਦੋ ਬੜੇ ਫੇਮਸ ਇੱਕ ਬੇਕ ਐਂਡ ਫਲੇਕ ਵੀ ਹੈ ਹੋਮ ਬੇਕਰ ਆ ਉਹ ਅਤੇ ਉਹਨਾਂ ਦੇ ਵੀ ਕੇਕਸ ਵਗੈਰਾ ਬਹੁਤ ਅੱਛੇ ਹੁੰਦੇ ਆ ਪੇਸਟਰੀਜ਼ ਹੋ ਗਈਆਂ ਬੜੀ ਵਧੀਆ ਅਤੇ ਡਰੀਮ ਬੇਕਰਜ਼ ਦੇ ਵੀ ਰੇਡ ਵੈਲਵੈਟ ਕੇਕ ਬਹੁਤ ਅੱਛਾ ਤੁਸੀਂ ਜਾ ਕੇ ਇੱਕ ਵਾਰੀ ਉੱਥੇ ਜਾ ਕੇ ਟਰਾਈ ਕਰ ਸਕਦੇ ਹੋ ਹਾਂਜੀ ਹਾਂਜੀ ਐਡਰੈਸ ਮੈਂ ਤੁਹਾਨੂੰ ਸੈਂਡ ਕਰ ਦੂ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਭੇਜ ਦਾਂਗੀ ਜੀ ਭੇਜ ਦਾਂਗੀ ਜੀ ਤੁਸੀਂ ਚੈਨਲ ਪ੍ਰੋ ਕਰਨ ਵਾਸਤੇ ਜੀ ਆ ਆਪਣੇ ਰੈਸਟੋਰੈਂਟ ਹੋ ਗਏ ਛੋਟੇ ਛੋਟੇ ਅਤੇ ਫੇਮਸ ਹੈਗੇ ਅਤੇ ਪੇਪਰ ਹੈਗਾ ਫੇਮਸ ਉੱਥੇ ਵੀ ਤੁਸੀਂ ਜਾ ਕੇ ਇਹ ਵਲੋਗ ਬਣਾ ਸਕਦੇ ਹੋ ਅੱਛਾ ਅੱਛਾ ਅੱਛਾ ਹਾਂ ਹਾਂ ਹਾਂ ਹਾਂਜੀ ਅੱਛਾ ਅੱਛਾ ਹਮ ਹਮ ਹਮ ਅਰਜਨ ਬੇਕਰੀਜ ਰਾਮਾ ਬੇਕਰੀਜ ਇਹ ਹਮ ਹਮ ਹਮ ਇਹ ਵੀ ਕਾਫੀ ਪੁਰਾਣੀਆਂ ਬੇਕਰੀਜ ਹੈਗੀਆਂ ਹੈਗੀਆਂ ਕਾਫੀ ਟਾਈਮ ਤੋਂ ਚੱਲ ਰਹੀਆਂ ਅਤੇ ਫੇਮਸ ਵੀ ਨੇ ਜ਼ਿਆਦਾ ਵੱਡੀਆਂ ਵੀ ਨਹੀਂ ਅਤੇ ਪਰ ਨਾਮ ਬੜਾ ਅੱਛਾ ਇਹਨਾਂ ਦਾ ਇਹਨਾਂ ਦੇ ਕੇਕਸ ਬੜੇ ਵਧੀਆ ਨੇ ਅਤੇ ਇੱਥੇ ਵੀ ਤੁਸੀਂ ਜਾ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਮੈਂ ਤਕਰੀਬਨ ਸਾਰੀਆਂ ਬੇਕਰੀਜ ਤੋਂ ਉਹ ਖਾ ਚੁੱਕੀ ਹਾਂ ਟਰਾਈ ਕਰ ਚੁੱਕੀ ਹਾਂ ਅਤੇ ਵਧੀਆ ਨੇ ਸਾਰੀ ਜਗ੍ਹਾ 'ਤੇ ਬਹੁਤ ਇੱਥੇ ਟਿਮ ਬੇਕਰਜ਼ ਵੀ ਹੈਗੇ ਆ ਰੋਡ 'ਤੇ ਉੱਥੇ ਵੀ ਤੁਸੀਂ ਜਾ ਸਕਦੇ ਹੋ ਹਾਂਜੀ ਉੱਥੇ ਵੀ ਜਾ ਸਕਦੇ ਹੋ ਹਾਂਜੀ ਜ਼ਰੂਰ ਜੀ ਮੈਂ ਤੁਸੀਂ ਟਾਈਮ ਕੱਢੋ ਫਰੀ ਵੇਲੇ ਅਤੇ ਤੁਸੀਂ ਮਿਲ ਲਓ ਅਤੇ ਸ਼ਾਮ ਦੇ ਟਾਈਮ 'ਤੇ ਆਪਾਂ ਜਾ ਸਕਦੇ ਹਾਂ ਤੁਹਾਡੇ ਵਲੋਗ ਵੀ ਬਣ ਜਾਣਗੇ ਨਾਲੇ ਤੁਹਾਡੇ ਵੱਲੋਂ ਥੋੜ੍ਹਾ ਜਿਹਾ ਛੋਟੀ ਮੋਟੀ ਪਾਰਟੀ ਵੀ ਹੋ ਜੂਗੀ ਹਾਂਜੀ ਹਾਂਜੀ ਮੈਂ ਵੇਖਿਆ ਸੀਗਾ ਤੁਹਾਡੇ ਬਿਲਕੁਲ ਬਿਲਕੁਲ ਹਾਂਜੀ ਜ਼ਰੂਰ ਜੀ ਜ਼ਰੂਰ ਮੈਂ ਵੇਖਿਆ ਸੀਗਾ ਤੁਹਾਡੀਆਂ ਵੀਡੀਓਜ ਵਲੋਗ ਦੇਖੇ ਸੀਗੇ ਬੜੇ ਵਧੀਆ ਬਣੇ ਹੋਏ ਹੈਗੇ ਆ ਬਾਕੀ ਹੋਰ ਹੌਲੀ ਹੌਲੀ ਕੰਮ ਵਧੇਗਾ ਜੀ ਇੱਦਾਂ ਹੀ ਮਿਹਨਤ ਕਰਨੀ ਪੈਣੀ ਆਪਾਂ ਨੂੰ ਜੀ ਜ਼ਰੂਰ ਜੀ ਜ਼ਰੂਰ ਹਮ ਹਾਂਜੀ ਹਾਂਜੀ ਬੇਕਰੀਜ਼ ਫਿਰ ਇਹ ਹੈਗੀਆਂ ਸਾਰੀਆਂ ਤੁਸੀਂ ਜਾ ਕੇ ਵਲੋਗ ਬਣਾ ਸਕਦੇ ਹੋ ਟਰਾਈ ਕਰ ਸਕਦੇ ਹੋ ਅਤੇ ਖਾਣਾ ਬੜਾ ਵਧੀਆ ਇਹਨਾਂ ਦਾ ਫੇਮਸ ਹੀ ਇਹ ਕੇਕ ਵਾਸਤੇ ਹੈਗੀਆਂ ਸਾਰੀਆਂ ਅਤੇ ਆਈਡਰੀਮ ਵਾਲਿਆਂ ਦਾ ਤਾਂ ਤੁਸੀਂ ਮੈਂ ਪਰਸਨਲ ਤੁਹਾਨੂੰ ਉਹ ਦਊਂਗੀ ਸਲਾਹ ਦਊਂਗੀ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਹੋ ਕੇ ਆਓ

ਹਾਂਜੀ ਹਾਂਜੀ ਹਾਂਜੀ ਇਹਨਾਂ ਦੀ ਇੱਕ ਚੀਜ਼ ਪੈਟੀ ਹੈਗੀ ਹੈ ਜੀ ਉਹ ਵੀ ਬੜੀ ਫੇਮਸ ਹੈਗੀ ਹੈ ਪੇਸਟਰੀਜ਼ ਤਾਂ ਇਹਨਾਂ ਦੀਆਂ ਹੈਗੀਆਂ ਵਧੀਆ ਇਹਨਾਂ ਦੀ ਇੱਕ ਚੀਜ਼ ਕਰੀਮ ਚੀਜ਼ ਪੈਟੀ ਹੈ ਜੀ ਉਹ ਸ਼ਾਮ ਨੂੰ ਖਤਮ ਹੋ ਜਾਂਦੀ ਹੈ ਜੀ ਥੋੜ੍ਹੇ ਟਾਈਮ ਬਾਅਦ ਮੈਨੂੰ ਲੱਗਦਾ ਇੱਕ ਇੱਕ ਡੇਢ ਘੰਟੇ ਹਾਂਜੀ ਡੇਢ ਘੰਟੇ ਵਾਸਤੇ ਰੱਖਦੇ ਆ ਇਹ ਅਤੇ ਇੰਨੇ ਚਿਰ 'ਚ ਤਾਂ ਖਤਮ ਹੋ ਜਾਂਦੀ ਹੈ ਅਤੇ ਬੜਾ ਅ ਅੱਛਾ ਟੇਸਟ ਹੈਗਾ ਜੀ ਉਹਦਾ ਤੁਸੀਂ ਉੱਥੇ ਜਾ ਕੇ ਉਹ ਵੀ ਟਰਾਈ ਕਰ ਸਕਦੇ ਹੋ ਅਤੇ ਜਾਓ ਇਕ ਵਾਰੀ ਘੁੰਮੋ ਫਿਰੋ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਤੁਸੀਂ ਕੱਢੋ ਟਾਈਮ ਕੱਢੋ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰ ਦਿਓ ਅਤੇ ਫਿਰ ਆਪਾਂ ਚਲਦੇ ਹਾਂ ਮਿਲਦੇ ਹਾਂ ਓਕੇ ਜੀ ਓਕੇ ਧੰਨਵਾਦ ਬਾਏ ਜੀ ਬਾਏ